ਵੈਸੇ ਤਾਂ ਮੈਂ ਘੁੰਮਣ ਦਾ ਬਹੁਤ ਜ਼ਿਆਦਾ ਸ਼ੌਕੀਨ ਹਾਂ ਪਰ ਜਦੋਂ ਕੋਈ ਕਿਸੇ ਨਵੀਂ ਥਾਂ 'ਤੇ ਜਾਂਦੇ ਹਾਂ ਤਾਂ ਸਾਨੂੰ ਅਲੱਗ ਅਲੱਗ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਕਿ ਜਦੋਂ ਅਸੀਂ ਪਹਾੜੀ ਏਰੀਏ ਵਿੱਚ ਜਾਂਦੇ ਹਾਂ ਤਾਂ ਸਾਨੂੰ ਉੱਥੇ ਵੀ ਕਾਫੀ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨ ਪੈਂਦਾ ਹੈ ਜਿਵੇਂ ਕਿ ਸਾਨੂੰ ਇੱਕ ਥਾਂ ਤੋਂ ਦੂਜੀ ਥਾਂ ਜਾਣ ਲਈ ਪੈਦਲ ਯਾਤਰਾ ਕਰਨੀ ਪੈਂਦੀ ਹੈ ਜੇ ਅਸੀਂ ਕਿਸੇ ਸਾਧਨ 'ਤੇ ਜਾਂਦੇ ਹਾਂ ਤਾਂ ਸਾਨੂੰ ਆਪਣਾ ਸਮਾਨ ਨਾਲ ਹੀ ਕੈਰੀ ਕਰਨਾ ਪੈਂਦਾ ਹੈ ਅਤੇ ਉੱਥੇ ਪੈਟਰੋਲ ਡੀਜ਼ਲ ਜਾਂ ਹੋਰ ਟਾਇਰਾਂ ਦੀਆਂ ਦੁਕਾਨਾਂ ਵੀ ਸਾਨੂੰ ਬਹੁਤ ਜ਼ਿਆਦਾ ਘੱਟ ਮਿਲਦੀਆਂ ਹਨ ਜਿਸ ਕਰਕੇ ਸਾਨੂੰ ਇਹ ਮੁਸ਼ਕਿਲਾਂ ਬਹੁਤ ਜ਼ਿਆਦਾ ਆਉਂਦੀਆਂ ਹਨ ਅਤੇ ਸਾਨੂੰ ਉੱਥੇ ਕਮਰੇ ਦੇ ਰੈਂਟ ਵਗੈਰਾ ਜਾਂ ਰੂਮ ਵਗੈਰਾ ਵੀ ਬਹੁ ਜ਼ਿਆਦਾ ਰੇਟ 'ਤੇ ਮਿਲਦੇ ਹਨ ਜਿਸ ਕਰਕੇ ਅਤੇ ਪਹਾੜੀ ਏਰੀਏ ਵਿੱਚ ਪਹਾੜੀ ਖਾਣਾ ਹੀ ਮਿਲਦਾ ਹੈ ਜੋ ਕਿ ਆਮ ਸਾਦੇ ਖਾਣੇ ਨਾਲੋਂ ਬਹੁਤ ਜ਼ਿਆਦਾ ਕੋਸਟਲੀ ਹੁੰਦਾ ਹੈ ਅਤੇ ਜ਼ਿਆਦਾ ਮਹਿੰਗਾ ਹੁੰਦਾ ਹੈ ਇਸ ਕਰਕੇ ਸਾਨੂੰ ਪਹਾੜੀ ਏਰੀਏ ਵਿੱਚ ਇਹਨਾਂ ਚੀਜ਼ਾਂ ਦਾ ਬਹੁਤ ਜ਼ਿਆਦਾ ਮੁਸ਼ਕਿਲਾਂ ਆਉਂਦੀਆਂ ਹਨ ਅਤੇ ਜੇ ਅਸੀਂ ਦੇਖੀਏ ਸਾਊਥ ਵਾਲੀ ਸਾਈਡ ਜੋ ਕਿ ਸਮੁੰਦਰ ਵਾਲੇ ਵੱਲ ਹੁੰਦਾ ਹੈ ਇਹਨਾਂ ਏਰੀਆ ਵਿੱਚ ਵੀ ਸਾਨੂੰ ਬਹੁਤ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਵਿੱਚ ਜ਼ਿਆਦਾਤਰ ਸਮੁੰਦਰੀ ਖਾਣਾ ਹੀ ਮਿਲਦਾ ਹੈ ਅਤੇ ਜੇ ਅਸੀਂ ਨੋਰਮਲ ਖਾਣਾ ਖਾਣ ਲਈ ਦੇਖਦੇ ਹਾਂ ਤਾਂ ਉਹਦੀ ਕੀਮਤ ਬਹੁਤ ਜ਼ਿਆਦਾ ਹੁੰਦੀ ਹੈ ਜਿਸ ਕਰਕੇ ਜਿਸ ਕਰਕੇ ਅਸੀਂ ਦੂਸਰੀ ਥਾਂ 'ਤੇ ਜਾ ਕੇ ਸਾਨੂੰ ਬਹੁਤ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਲਈ ਅਤੇ ਇਸ ਲਈ ਨਵੀਆਂ ਨਵੀਆਂ ਥਾਵਾਂ 'ਤੇ ਜਾ ਕੇ ਸਾਨੂੰ ਇਹਨਾਂ ਮੁਸ਼ਕਿਲਾਂ ਆਉਂਦੀਆਂ ਹਨ ਅਤੇ ਇਹਨਾਂ ਵਿੱਚੋਂ ਹੋਰ ਵੀ ਬਹੁਤ ਸਾਰੀਆਂ ਮੁਸ਼ਕਿਲਾਂ ਹਨ ਜੋ ਕਿ ਸਾਨੂੰ ਨਵੀਂ ਥਾਵਾਂ 'ਤੇ ਆਉਂਦੀਆਂ ਹਨ ਧੰਨਵਾਦ